ਜਿਵੇਂ ਕਿ ਤੁਸੀਂ ਪੁੱਛਿਆ ਜਿਚ ਵੀ ਯੋਗਾ ਦਾ ਅਭਿਆਸ ਹੈ ਵੀ ਜਿਹਦੇ ਯੋਗਾ ਦੇ ਅਭਿਆਸ ਨਾਲ ਭਾਈਚਾਰੇ ਦੀ ਭਾਵਨਾ ਜਾਂ ਦੂਜਿਆਂ ਨਾਲ ਸੰਬੰਧ ਪੈਦਾ ਕਰ ਸਕਦੇ ਹਾਂ ਇਹ ਵਾਕਈ ਸਹੀ ਗੱਲ ਹੈ ਯੋਗਾ ਦੇ ਅਭਿਆਸ ਵਗੈਰਾ ਕਰਨ ਨਾਲ ਅਸੀਂ ਆਪਸ 'ਚ ਭਾਈਚਾਰੇ ਦੀ ਭਾਵਨਾ ਅਤੇ ਦੂਜਿਆਂ ਨਾਲ ਚੰਗੇ ਸੰਬੰਧ ਵੀ ਸਥਾਪਿਤ ਕਰ ਸਕਦੇ ਹਾਂ ਜਿਵੇਂ ਕਿ ਹੁਣ ਸਾਡਾ ਹੀ ਮੰਨ ਲਓ ਵੀ ਮੈਂ ਇੱਕ ਸਾਲ ਤੋਂ ਵੀ ਸੈਸ਼ਨ ਜੁਆਇਨ ਕਰ ਰਹੀ ਹਾਂ ਜੂਮ ਲਿੰਕ ਰਾਹੀਂ ਤਾਂ ਉਹਦੇ 'ਚ ਕੀ ਹੁੰਦਾ ਅਸੀਂ ਕਈ ਕਈ ਥਾਵਾਂ ਦੇ ਪਰਸਨ ਜੁੜੇ ਆਪਸ 'ਚ ਜਿਹਨਾਂ ਨੂੰ ਆਪਾਂ ਕਦੇ ਮਿਲੇ ਵੀ ਨਹੀਂ ਹੁੰਦੇ ਦੇਖਿਆ ਵੀ ਨਹੀਂ ਹੁੰਦਾ ਪਰ ਜਦੋਂ ਅਸੀਂ ਇਕੱਠੇ ਐਕਸਰਸਾਈਜ਼ ਵਗੈਰਾ ਜਾਂ ਯੋਗਾ ਵਗੈਰਾ ਕਰਦੇ ਹਾਂ ਇੱਕ ਦੂਜੇ ਨਾਲ ਉੱਥੇ ਜ਼ੂਮ 'ਚ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਬੜੇ ਬੜੇ ਪਰਸਨ ਨਾਲ ਗੱਲ ਕਰਨ ਦਾ ਮਿਲਣ ਮਿਲਣਾ ਤਾਂ ਕੀ ਹੈ ਵੀ ਜ਼ੂਮ ਰਾਹੀਂ ਮੌਕਾ ਮਿਲਦਾ ਅਤੇ ਆਪਸ 'ਚ ਇੰਨਾ ਮੋਹ ਪਿਆਰ ਬਣ ਜਾਂਦਾ ਵੀ ਐਂ ਲੱਗਦਾ ਵੀ ਆਪਾਂ ਕੱਲ ਪਤਾ ਨਹੀਂ ਕਈ ਵਾਰ ਸਦੀਆਂ ਤੋਂ ਉਹਨਾਂ ਨਾਲ ਮਿਲੇ ਹਾਂ ਤਾਂ ਇਸ ਕਰਕੇ ਫੀਲ ਹੁੰਦਾ ਵੀ ਵਧੀਆ ਚੀਜ਼ ਹੈ ਇਹ ਅਤੇ ਵਾਕੇ ਵੀ ਇਸ ਤਰ੍ਹਾਂ ਦੂਜਿਆਂ ਨਾਲ ਸੰਬੰਧ ਬਣਦੇ ਆ ਹੁਣ ਅਸੀਂ ਕਾਫੀ ਇੰਨਾ ਸਰਕਲ ਆਦੀ ਕਈ ਕੋਈ ਸ਼ਿਮਲੇ ਤੋਂ ਹੈ ਕੋਈ ਜੰਮੂ ਵਗੈਰਾ ਕੋਈ ਦਿੱਲੀ ਕਿਤੋਂ ਕਿਤੋਂ ਦੇ ਪਰਸਨ ਸਾਡੇ ਜੁੜੇ ਹੋਏ ਆ ਜਿਹੜੇ ਕਿ ਜਿਹਨਾਂ ਨਾਲ ਅਸੀਂ ਆਪਸ 'ਚ ਕੰਸਲਟ ਗੱਲਬਾਤ ਕਰਦੇ ਹਾਂ ਜੂਮ ਰਾਹੀਂ ਮਿਲਦੇ ਹਾਂ ਤਾਂ ਵਧੀਆ ਫੀਲ ਹੁੰਦਾ ਆਪਸ 'ਚ ਇੱਕ ਦੂਜੇ ਦੇ ਦੁੱਖਾਂ ਸੁੱਖਾਂ ਬਾਰੇ ਵੀ ਪਤਾ ਲੱਗਦਾ ਸਾਨੂੰ ਕਿਉਂਕਿ ਇਹਦੇ ਨਾਲ ਸਾਡੇ ਹੋਰ ਵੀ ਕੁਝ ਸੈਸ਼ਨ ਚਲਦੇ ਆ ਜਿਹਦੇ 'ਚ ਵੀ ਜਿਹਦੇ 'ਚ ਅਸੀਂ ਆਪਸ 'ਚ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹੈ ਮਿਲਦੇ ਹੈ ਅਤੇ ਸਾਰਾ ਕੋਈ ਆਪਦਾ ਦੁੱਖਾਂ ਸੁੱਖ ਜੋ ਵੀ ਹੈ ਕੋਈ ਗੱਲਬਾਤ ਫੈਮਿਲੀ ਮੈਂਬਰ ਕਈ ਵਾਰੀ ਅਸੀਂ ਜਦੋਂ ਇਸ ਸੈਸ਼ਨ 'ਚ ਇਸ ਤਰ੍ਹਾਂ ਜੁੜਦੇ ਹਾਂ ਤਾਂ ਅਸੀਂ ਆਪਦੇ ਫੈਮਿਲੀ ਬਾਰੇ ਵੀ ਗੱਲਬਾਤ ਕਰਦੇ ਹਾਂ ਕੋਈ ਦੁੱਖ ਤਕਲੀਫ ਹੈ ਉਹ ਗੱਲ ਵੀ ਕਰਦੇ ਹਾਂ ਅਤੇ ਤਾਂ ਕਰਕੇ ਇਸ ਕਰਕੇ ਵਧੀਆ ਹੈ ਵੀ ਯੋਗਾ ਵਾਲਾ ਜਾਂ ਐਕਸਰਸਾਈਜ਼ ਵਾਲਾ ਵੀ ਵਾਕੇ ਗੱਲ ਸਹੀ ਹੈ ਵੀ ਦੂਜਿਆਂ ਨਾਲ ਸੰਬੰਧ ਤਾਂ ਪੈਦਾ ਹੁੰਦੇ ਹਨ ਅਤੇ ਬਾਕੀ ਜੋ ਨਾਲੇ ਆਪਾਂ ਸਾਰੀ ਹੈਲਥ ਅੱਛੀ ਕਰਦਾ ਕਰਦੇ ਹਾਂ ਆਪਣੀ ਸਾਰੀ ਜੋ ਵੀ ਆ ਬਾਡੀ ਦੀਆਂ ਜੋ ਬੋਡੀ ਸ਼ੇਪ 'ਚ ਆਉਂਦੀ ਹੈ ਵਧੀਆ ਦਿਸਣ ਲੱਗ ਪੈਨੇ ਹਾਂ ਐਕਟਿਵ ਰਹਿੰਦੇ ਹਾਂ ਪੂਰਾ ਪੂਰਾ ਦਿਨ ਨਾਲੇ ਮਨ ਸ਼ਾਂਤ ਹੁੰਦਾ ਕੋਈ ਵੀ ਹੈ ਜਿਹੜੇ ਦੇਖੋ ਕਈ ਵਾਰੀ ਆਪਾਂ ਨੂੰ ਘਰਾਂ 'ਚ ਸੌ ਟੈਂਸ਼ਨਾਂ ਹੁੰਦੀਆਂ ਪਰ ਜਦੋਂ ਆਪਾਂ ਕੋਈ ਦਸ ਪੰਦਰ੍ਹਾਂ ਮਿੰਟ ਇਕੱਲੇ ਆਪਦੇ ਲਈ ਲਾਨੇ ਹਾਂ ਆਪਦੇ ਲਈ ਸੋਚਦੇ ਹਾਂ ਆਪਦੀ ਬਾਡੀ ਬਾਰੇ ਸੋਚਦੇ ਹਾਂ ਜਾਂ ਸ਼ਾਂਤ ਮਨ ਨਾਲ ਬੈਠ ਕੇ ਕੋਈ ਆਪਣੇ ਬਚਪਨ ਦੀਆਂ ਗੱਲਾਂ ਜਾਂ ਕੁਛ ਵੀ ਯੋਗਾ ਵਗੈਰਾ ਕਰਨ ਲੱਗੇ ਯਾਦ ਕਰਦੇ ਹਾਂ ਤਾਂ ਉਹਦੇ ਨਾਲ ਆਪਣਾ ਮਨ ਵੀ ਸ਼ਾਂਤ ਹੁੰਦਾ ਹੈ ਖੁਸ਼ੀ ਮਿਲਦੀ ਹੈ ਕੁਛ ਆਪਾਂ ਆਪਦੇ ਯਾਦ ਕਰਦੇ ਹਾਂ ਕਿਉਂਕਿ ਜਦੋਂ ਆਪਾਂ ਯੋਗਾ 'ਚ ਜਦੋਂ ਧਿਆਨ ਲਗਾ ਕੇ ਬੈਠਦੇ ਹਾਂ ਨਾ ਤਾਂ ਆਪਾਂ ਨੂੰ ਬਹੁਤ ਕੁਛ ਆਪਣੇ ਬਚਪਨ ਬਾਰੇ ਆਪਣੇ ਕੋਈ ਪੇਰੈਂਟਸ ਮਾਂ ਪਿਓ ਕੁਛ ਵੀ ਅੱਛੀਆਂ ਗੱਲਾਂ ਕਾਫੀ ਕੁਛ ਆਪਣੇ ਦਿਮਾਗ 'ਚ ਆਉਂਦਾ ਤਾਂ ਉਹ ਵਧੀਆ ਪੂਰਾ ਆਪਾਂ ਫੀਲ ਕਰਦੇ ਹਾਂ ਰਿਫਰੈ ਫਰੈਸ਼ ਫੀਲ ਕਰਦੇ ਹਾਂ ਪੂਰਾ ਦਿਨ ਤਾਂ ਇਸ ਕਰਕੇ ਯੋਗਾ ਸਭ ਤੋਂ ਬੈਸਟ ਚੀਜ਼ ਹੈ ਜਿਹੜਾ ਕਿ ਆਪਾਂ ਨੂੰ ਪੂਰਾ ਦਿਨ ਖੁਸ਼ ਰੱਖਦਾ ਹੈ ਪੂਰਾ ਦਿਨ ਐਕਟਿਵ ਰੱਖਦਾ ਹੈ ਔਰ ਦੂਜਿਆਂ ਨਾਲ ਗੱਲਬਾਤ ਕਰਨ ਦਾ ਆਪਦੇ ਕਿਉਂਕਿ ਜੋ ਵੀ ਕੋਈ ਆਪਣੀ ਗੱਲ ਆਪਾਂ ਦੂਜੇ ਨਾਲ ਜਦੋਂ ਕਰ ਲੈਂਦੇ ਹਾਂ ਨਾ ਤਾਂ ਆਪਣਾ ਮਨ ਹਲਕਾ ਹੋ ਜਾਂਦਾ ਸੀ ਥੈਂਕ ਯੂ